ਹਾਈਕਿੰਗ ਟਰੈਕਿੰਗ ਦੌਰਾਨ ਮੱਛਰ ਵਾਲੀ ਜਗ੍ਹਾ ਉੱਤੇ ਬਚਾਅ ਲਈ ਕੁੱਝ ਸਾਧਾਰਣ ਪ੍ਰਬੰਧ ਕੀਤੇ ਜਾ ਸਕਦੇ ਹਨ ਸਭ ਤੋਂ ਪਹਿਲਾਂ ਮੱਛਰਾਂ ਤੋਂ ਬਚਣ ਲਈ ਮੱਛਰ ਰੀਪੈਲੈਂਟ ਵਰਤਣਾ ਚਾਹੀਦਾ ਹੈ ਜੋ ਸਰੀਰ 'ਤੇ ਲਗਾਇਆ ਜਾ ਸਕਦਾ ਹੈ ਇਸ ਤੋਂ ਇਲਾਵਾ ਜੰਗਲ ਜਾਂ ਨਦੀ ਦੇ ਨੇੜੇ ਕੈਂਪ ਕਰਨ ਵੇਲੇ ਮੱਛਰ ਨੈੱਟ ਵੀ ਲਗਾਉਣਾ ਫਾਇਦੇਮੰਦ ਹੈ ਮੱਛਰਾਂ ਨੂੰ ਦੂਰ ਰੱਖਣ ਵਾਲੀਆਂ ਚੀਜ਼ਾਂ ਵਿੱਚ ਨੈਚੂਰਲ ਓਇਲਸ ਜਿਵੇਂ ਕਿ ਲਵੈਨਡਰ ਓਏਲ ਸ਼ਾਮਿਲ ਹਨ ਮੇਰੀ ਯਾਦ ਵਿੱਚ ਇੱਕ ਵਾਰੀ ਹਾਈਕਿੰਗ ਦੌਰਾਨ ਜਦੋਂ ਮੈਂ ਇੱਕ ਜੰਗਲ ਦੇ ਨੇੜੇ ਕੈਂਪ ਕੀਤਾ ਸੀ ਮੱਛਰ ਬਹੁਤ ਹੀ ਜ਼ਿਆਦਾ ਤੰਗ ਕਰ ਰਹੇ ਸਨ ਰਾਤ ਨੂੰ ਉਹ ਮੇਰੇ ਕੋਲ ਆ ਕੇ ਬਹੁਤ ਪ੍ਰੇਸ਼ਾਨ ਕਰ ਰਹੇ ਸਨ ਮੈਂ ਆਪਣੇ ਬੈਗ ਵਿੱਚੋਂ ਮੱਛਰ ਰੀਪੈਲੈਂਟ ਕੱਢਿਆ ਅਤੇ ਲਗਾਇਆ ਅਤੇ ਮੱਛਰ ਨੈੱਟ ਨਾਲ ਲਾ ਕੇ ਸੌ ਗਿਆ ਕੁੱਛ ਸਮੇਂ ਬਾਅਦ ਮੈਨੂੰ ਥੋੜ੍ਹੀ ਰਾਹਤ ਮਹਿਸੂਸ ਹੋਈ